ਹਾਂਜੀ ਸਾਨੂੰ ਵਕੀਲ ਪੁਲਿਸ ਪੰਚਾਇਤ ਜਾਂ ਤਹਿਸੀਲ ਦਫਤਰ ਦੇ ਲੋਕਾਂ ਵਰਗੇ ਹੈ ਨਾ ਕਨੂੰਨੀ ਅਧਿਕਾਰੀਆਂ ਕਾਰਨ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਆਮ ਜ਼ਿੰਦਗੀ 'ਚ ਸਾਹਮਣਾ ਕਰਨਾ ਪੈਂਦਾ ਜਿਵੇਂ ਮੁਸ਼ਕਿਲਾਂ ਨੇ ਜਿਵੇਂ ਅਸੀਂ ਆਪਣੇ ਘਰ ਦੇ ਰਜਿਸਟਰੀ ਚੈੱਕ ਕਰਵਾਉਣੀ ਸੀ ਤਾਂ ਤਹਿਸੀਲਦਾਰ ਸਾ ਸਾਹਿਬ ਨੇ ਜਿਹੜੇ ਉਹ ਦਫਤਰ ਦੇ ਵਿੱਚ ਸਾਰਾ ਦਿਨ ਪਹਿਲਾਂ ਬੈਠੇ ਹੀ ਨਹੀਂ ਕਹਿ ਰਹੇ ਸੀ ਉਹ ਖੇਤਾਂ ਦੇ ਵਿੱਚ ਗਏ ਹੋਏ ਨੇ ਕਿਸੇ ਦਫਤਰ 'ਚ ਲੋਕਾਂ ਕੋਲ ਗਏ ਹੋਏ ਨੇ ਜਦ ਛੁੱਟੀ ਹੋਣ ਲੱਗਦਾ ਟਾਈਮ ਹੋਇਆ ਫਿਰ ਉਹ ਕਹਿੰਦੇ ਅੱਜ ਨਹੀਂ ਤਾਂ ਕੱਲ੍ਹ ਮਿਲਣਗੇ ਉਹ ਕਿਸੇ ਕੰਮ 'ਚ ਬਾਹਰ ਬੀਜ਼ੀ ਨੇ ਪ ਇੰਨੇ ਕਾਫੀ ਦਿਨ ਲੰਘ ਗਏ ਸੀ ਜਿਹੜਾ ਸਾਡਾ ਆਪਣਾ ਮੇਨ ਕੰਮ ਸੀ ਜਿਹੜਾ ਸਾਡਾ ਜ਼ਰੂਰੀ ਕੰਮ ਕਰਕੇ ਅਸੀਂ ਉਹਨਾਂ ਦੇ ਦਫਤਰ 'ਚ ਗਏ ਸੀਗੇ ਤਾਂ ਉਹ ਸਾਡਾ ਕੰਮ ਆ ਜਿਹੜਾ ਉਹ ਵਿੱਚ ਵਿਚਾਲੇ ਹੀ ਰਹਿ ਗਿਆ ਸੀ